ਆਪਾਂ ਗੱਲ ਕਰਨ ਜਾ ਰਹੇ ਹਾਂ ਉਨ ਖੇ ਸਾਡੇ ਖੇਤਰਾਂ ਦੇ ਸਰੋਤਾਂ ਦੇ ਬਾਰੇ ਸਰੋਤਾਂ ਦੇ ਰਿਸੋਰਸ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਸਾਡੇ ਇੱਥੇ ਰੇਤਾ ਬਹੁਤ ਜ਼ਿਆਦਾ ਹੁੰਦਾ ਇੱਥੇ ਰੇਤੇ ਦੀਆਂ ਖੱਡਾਂ ਬਹੁਤ ਜ਼ਿਆਦਾ ਨੇ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਪਿੰਡਾਂ ਦੇ ਲੋਕ ਸ਼ਹਿਰ ਵੱਲ ਨੂੰ ਆ ਰਹੇ ਨੇ ਅਤੇ ਉਹ ਇੱਥੇ ਕੰਸਟਰਕਸ਼ਨ ਦਾ ਅਤੇ ਨਵੀਂ ਕਾਲਨੀਜ ਸੋਸਾਇਟੀਸ ਦਾ ਕੰਮ ਬਹੁਤ ਜ਼ਿਆਦਾ ਜ਼ੋਰ ਸ਼ੋਰ 'ਤੇ ਚੱਲ ਰਿਹਾ ਸਾਡੇ ਸ਼ਹਿਰ ਦੀ ਗੱਲ ਕਰ ਲਓ ਇੱਥੇ ਨਵੀਂ ਘੱਟੋ ਘੱਟ ਵੀ ਸੱਤ ਅੱਠ ਕਲੋਨੀਆਂ ਡਿਵੈਲਪ ਹੋ ਰਹੀਆਂ ਨੇ ਅਤੇ ਉਹਦੇ ਵਿੱਚ ਕੀ ਹੁੰਦਾ ਕਿ ਸੀਮਿੰਟ ਦੇ ਨਾਲ ਰੇਤਾ ਮਿਕਸ ਹੁੰਦਾ ਇੱਥੇ ਰੇਤਾ ਰੇਤੇ ਦੀਆਂ ਖੱਡਾਂ ਬਹੁਤ ਜ਼ਿਆਦਾ ਨੇ ਅਨਗਿਨਤ ਨੇ ਨੈਚੁਰਲ ਰਿਸੋਰਸ ਆ ਸਾਡੇ ਇੱਥੇ ਦਾ ਅਤੇ ਇਹਦੇ ਵਿੱਚ ਆਪਾਂ ਇਹ ਬਹੁਤ ਵਧੀਆ ਸਰੋਤ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ